ਮੇਰੇ ਦੁਆਰਾ ਪੜ੍ਹੀ ਗਈ ਆਖਰੀ ਕਿਤਾਬ ਦ ਸਟੌਰੀ ਔਫ਼ ਮਾਈ ਲਾਈਫ਼ ਸੀ ਜਿਸ ਵਿੱਚ ਜੋ ਕਿ ਹੈਲਨ ਕੈਲਰ ਦੀ ਔਟੋਬਾਇਉਗ੍ਰਾਫੀ ਹੈ ਉਸ ਦੇ ਵਿੱਚ ਮੈਂ ਸਿੱਖਿਆ ਕਿ ਕਿਵੇਂ ਸਾਨੂੰ ਆਪਣੀ ਮੁਸ਼ਕਲਾਂ ਤੋਂ ਬਿਨ੍ਹਾਂ ਡਰੇ ਉਹਨਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਕਿਹੋ ਜਿਹੀ ਵੀ ਸਥਿਤੀ ਹੋਵੇ ਸਾਨੂੰ ਉਸ ਵਿੱਚ ਹਾਰ ਨਹੀਂ ਮੰਨਣੀ ਚਾਹੀਦੀ ਸਾਨੂੰ ਹਮੇਸ਼ਾ ਹੀ ਯਤਨ ਕਰਦੇ ਰਹਿਣੇ ਚਾਹੀਦੇ ਹਨ ਤਾਂ ਜੋ ਅਸੀਂ ਆਪਣੀ ਜ਼ਿੰਦਗੀ ਵਿੱਚ ਸਫ਼ਲ ਹੋ ਸਕੀਏ ਅਗਰ ਸਾਡੀ ਜ਼ਿੰਦਗੀ ਵਿੱਚ ਇੱਕ ਰਾਹ ਬੰਦ ਹੁੰਦਾ ਹੈ ਤਾਂ ਸਾਨੂੰ ਦੂਜੇ ਰਾਹ ਦੀ ਪਾਲਣਾ ਕਰਨੀ ਚਾਹੀਦੀ ਹੈ